ਹਾਂਜੀ ਵੀਰ ਜੀ ਨਮਸਤੇ ਜੀ ਕਿਹੜੀਆਂ ਕਿਹੜੀਆਂ ਸਬਜ਼ੀਆਂ ਰੱਖੀਆਂ ਨੇ ਜੀ ਆਪਾਂ ਅੱਛਾ ਜੀ ਸਬਜ਼ੀਆਂ ਤਾਂ ਲੈਣੀਆਂ ਨੇ ਬਟ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਨਾ ਸਬਜ਼ੀਆਂ ਕਿਹੜੀਆਂ ਸਹੀ ਆਉਂਦੀਆਂ ਅਤੇ ਥੋੜ੍ਹੀ ਜਿਵੇਂ ਔਰਗੈਨਿਕ ਜਿਹੀਆਂ ਸਬਜ਼ੀਆਂ ਕਿਹੜੀਆਂ ਉਹ ਦੱਸੋ ਆ ਖਾਦਾਂ ਖੂਦਾਂ ਤੁਹਾਨੂੰ ਪਤਾ ਅੱਜ ਕੱਲ੍ਹ ਬੜੀਆਂ ਚੱਲ ਗਈਆਂ ਅਤੇ ਫੇਰ ਉਹ ਸਹੀ ਨਹੀਂ ਰਹਿੰਦਾ ਕੰਮ

ਅੱਛਾ ਇਹ ਔਰਗੈਨਿਕ ਸਬਜ਼ੀਆਂ ਨੇ ਜੀ ਆਪਣੇ ਕੋਲ ਅੱਛਾ ਅੱਛਾ ਅੱਛਾ ਉਹ ਪਹਿਲੇ ਬਸ ਐਵੇਂ ਹੈ ਨਾ ਅਸੀਂ ਵੀ ਨਹੀਂ ਧਿਆਨ ਕਰਦੇ ਸੀ ਆ ਹੁਣ ਘਰ ਦੇ ਵਿੱਚ ਜਿਵੇਂ ਆ ਸਬਜ਼ੀਆਂ ਖਾ ਖਾ ਕੇ ਦੂਜੀਆਂ ਖਾਦਾਂ ਵਾਲੀਆਂ ਅਤੇ ਥੋੜ੍ਹੀ ਜਿਹੀ ਤੁਹਾਨੂੰ ਪਤਾ ਸਿਹਤ ਦੀਆਂ ਦਿੱਕਤਾਂ ਬੜੀਆਂ ਸ਼ੁਰੂ ਹੋ ਜਾਂਦੀਆਂ ਤਾਂ ਹੁਣ ਡਾਕਟਰ ਨੇ ਕਿਹਾ ਵੀ ਔਰਗੈਨਿਕ ਸਬਜ਼ੀਆਂ ਖਾਓ ਅਤੇ ਫਿਰ ਤੁਹਾਨੂੰ ਪਤਾ ਆਪਾਂ ਤਾਂ ਲੈਂਦੇ ਹੀ ਤੁਹਾਡੇ ਤੋਂ ਹਾਂ ਅਤੇ ਥੋੜ੍ਹੀਆਂ ਜਿਹੀਆਂ ਔਰ ਔਰਗੈਨਿਕ ਸਬਜ਼ੀਆਂ ਵੱਲ ਥੋੜ੍ਹਾ ਕਰਿਆ ਕਰੋ ਅੱਛਾ ਫਿਰ ਸਬਜ਼ੀਆਂ ਆਂ ਇੱਕ ਕੰਮ ਕਰ ਦਿਉ ਫਿਰ ਤੁਸੀਂ ਇਹ ਟਮਾਟਰ ਅਤੇ ਪਿਆਜ਼ ਅਤੇ ਇਹ ਤਾਂ ਕਰ ਹੀ ਦਿਉ ਤੁਸੀਂ ਪਹਿਲੇ ਹੀ ਕੱਢ ਦਿਉ ਆਪਣੇ ਆਪਣੇ ਪੱਕੇ ਤੁਸੀਂ ਇਹ ਡਿਲੀਵਰੀ ਕਰ ਹੀ ਦਿਆ ਕਰੋ ਇਹ ਦੋ ਚੀਜ਼ਾਂ ਤਾਂ ਰੋਜ਼ ਦੀਆਂ ਠੀਕ ਹੈ ਜੀ ਹਾਂਜੀ ਉਸ ਤੋਂ ਇਲਾਵਾ ਤੁਸੀਂ ਇਹ ਸਬਜ਼ੀਆਂ ਮਤਲਬ ਤੁਹਾਨੂੰ ਜਿਹੜੀ ਅਸੀਂ ਫੋਨ ਕਰਕੇ ਕੋਈ ਦੱਸ ਦਈਏ ਨਾ ਤੁਸੀਂ ਉਹ ਸਬਜ਼ੀ ਸਾਨੂੰ ਨਾਲ ਡਲੀਵਰ ਕਰ ਦਿਆ ਕਰੋ ਠੀਕ ਹੈ ਅਤੇ ਅੱਜ ਆਪਣੇ ਦੱਸੋ ਕਿਹੜੀ ਸਾਰਿਆਂ ਤੋਂ ਵਧੀਆ ਹੈ ਰੁੱਤ ਰੁੱਤ ਨਹੀਂ ਰੁੱਤ ਰੁੱਤ ਦੇ ਹਿਸਾਬ ਨਾਲ ਵੀ ਕੋਈ ਸਬਜ਼ੀ ਸੁਬਜ਼ੀ ਹੁੰਦੀ ਹੈ ਨਾ ਜਿਹੜੀ ਉਹ ਹੁਣ ਵਧੀਆ ਕਿਹੜੀ ਬਣੇਗੀ ਹਾਂ ਹਾਂ ਤੁਸੀ ਯਾਰ ਆਪਣੇ ਸਾਗ ਸਾਗ ਕਰ ਦਿਓ ਸਾਗ ਤਾਂ ਬੜੇ ਦਿਨ ਹੋ ਗਏ ਜੀ ਸਾਗ ਟ ਟਮਾਟਰ ਤੁਸੀਂ ਆਪਣੇ ਕਿੱਲੋ ਕਰ ਦਿਓ ਪਿਆਜ਼ ਕਿੱਲੋ ਕਰ ਦਿਓ ਉਹ ਵੀ ਕਿੱਲੋ ਹੀ ਕਰ ਦਿਓ ਤੁਸੀਂ ਅਤੇ ਵਿੱਚ ਨਾ ਉਹ ਧਨੀਆ ਧੁਨੀਆ ਨਹੀਂ ਭੁੱਲ ਜਾਣਾ ਉਹ ਵੀ ਪਾ ਦਿਓ ਸਬਜ਼ੀਆਂ ਆਪਣੇ ਔਰਗੈਨ ਹਾਂਜੀ ਸਬਜ਼ੀਆਂ ਨਾ ਜੀ ਆਪਣੇ ਔਰਗੈਨਿਕ ਵਾਲੀਆਂ ਹੀ ਰੱਖਿਓ ਆਪਾਂ ਨੂੰ ਉਹ ਦੂਜੀ ਖਾਦਾਂ ਖੂਦਾਂ ਵਾਲੀਆਂ ਸਬਜ਼ੀਆਂ ਨਹੀਂ ਚਾਹੀਦੀਆਂ ਹੰ ਹੰ ਹਾਂਜੀ ਬਸ ਬਸ ਫਿਰ ਉਹ ਉਹ ਤੁਸੀਂ ਔਰਗੈਨਿਕ ਵਾਲੀਆਂ ਸਬਜ਼ੀਆਂ ਉਹ ਤੁਹਾਨੂੰ ਮੈਂ ਦੱਸ ਦਿੱਤਾ ਟਮਾਟਰ ਅਤੇ ਪਿਆਜ਼ ਕਿੱਲੋ ਕਿੱਲੋ ਕਰ ਦਿਓ ਅਤੇ ਇੱਕ ਉਹ ਤੁਸੀਂ ਸਾਗ ਵੀ ਭੇਜ ਦਿਓ ਨਾਲ ਅਤੇ ਹਾਂ ਅਦਰਕ ਅਤੇ ਧਨੀਆ ਅਤੇ ਉਹ ਵੀ ਨਾਲ ਕਰ ਦਿਓ ਥੋੜ੍ਹਾ ਥੋੜ੍ਹਾ ਥੋੜ੍ਹਾ ਥੋੜ੍ਹਾ ਪਾ ਦਿਓ ਜ਼ਿਆਦਾ ਇੱਕ ਵਾਰੀ ਲੋੜ ਹੈ ਨਹੀਂ ਲੋੜ ਹੋਏਗੀ ਤਾਂ ਆਪਾਂ ਬਾਅਦ 'ਚ ਵੇਖ ਲਵਾਂਗੇ

ਅਤੇ ਤੁਸੀਂ ਆਪਣਾ ਹਾਂਜੀ ਖਾਤਾ ਖੂਤਾ ਲਾ ਲਉ ਸਬਜ਼ੀਆਂ ਦਾ ਕਿਉਂਕਿ ਤੁਹਾਨੂੰ ਪਤਾ ਹੁਣ ਰੋਜ਼ ਦੀ ਰੋਜ਼ ਐਨੀ ਸਬਜ਼ੀ ਆਪਾਂ ਲੈਣੀ ਹੁੰਦੀ ਹੈ ਅਤੇ ਫਿਰ ਰੋਜ਼ ਰੋਜ਼ ਪੇਮੈਂਟ ਥੋੜ੍ਹੀ ਔਖੀ ਹੋ ਜਾਂਦੀ ਕਦੀ ਰਹਿ ਵੀ ਜਾਂਦੀ ਕਦੇ ਭੁੱਲ ਵੀ ਜਾਂਦੇ ਹਾਂ ਅਤੇ ਤੁਸੀਂ ਆਪਣੇ ਖਾਤਾ ਲਾ ਲਓ ਜਿਵੇਂ ਜਿਵੇਂ ਤੁਸੀਂ ਕਹੋਗੇ ਆਪਾਂ ਉਵੇਂ ਹਿਸਾਬ ਕਰ ਲਿਆ ਕਰਾਂਗੇ ਹਫਤੇ ਦਾ ਮਹੀਨੇ ਦਾ ਹਾਂਜੀ ਹਾਂਜੀ ਉਹ ਤੁਸੀਂ ਦੱਸ ਦਿਓ ਆਪਾਂ ਉਵੇਂ ਹੀ ਕਰ ਦੇਵਾਂਗੇ ਬਸ ਤੁਹਾਨੂੰ ਪਤਾ ਹੈ ਤੁਹਾਡੇ ਕੋਲ ਇਸੇ ਕਰਕੇ ਆਏ ਹਾਂ ਕਿ ਵਿਸ਼ਵਾਸ ਹੈ ਕੀ ਕੀ ਆਪਾਂ ਨੂੰ ਔਰਗੈਨਿਕ ਚਾਹੀਦੀਆਂ ਬਸ ਹੁਣ ਡਾਕਟਰ ਨੇ ਮਨ੍ਹਾ ਕੀਤਾ ਬਾਕੀ ਕੁਝ ਖਾਣ ਤੋਂ ਹੈਂਜੀ ਹਾਂਜੀ ਬਸ ਇਹੀ ਨਾ ਉਹ ਨਹੀਂ ਤਾਂ ਆਪਾਂ ਨੂੰ ਪਤਾ ਤੁਹਾਨੂੰ ਰੇਹੜੀਆਂ ਹੋਰ ਵਾਧੂ ਘ ਘਰੋਂ ਘਰ ਵਾਧੂ ਹੋਰ ਸਮਾਨ ਆ ਜਾਂਦਾ ਬਟ ਆਪਾਂ ਇੱਥੇ ਆਏ ਹਾਂ ਕਿਉਂਕਿ ਵਿਸ਼ਵਾਸ ਬਣਿਆ ਹੋਇਆ ਆਪਣਾ ਹਾਂ ਐਂਏਂ ਤਾਂ ਉਹੀ ਗੱਲ ਹੈ ਡਾਕਟਰ ਨੇ ਵੀ ਕਿਹਾ ਅਤੇ ਅਸੀਂ ਤੇ ਕਿਹਾ ਨਹੀਂ ਸਾਡੇ ਵੱਲ ਤਾਂ ਪਹਿਲੇ ਹੀ ਹੈ ਹੀ ਔਰਗੈਨਿਕ ਵਾਲੇ ਹੀ ਹੈਗੇ ਹੈ ਪਰ ਮੈਂ ਕਿਹਾ ਚਲੋ ਇੱਕ ਵਾਰੀ ਹੋਰ ਕਹਿ ਦੇਵਾਂਗੇ ਅਤੇ ਕੋਈ ਹੁੰਦੀ ਹੈ ਨਾ ਵਿੱਚ ਵਿਚਾਲੇ ਚਲੋ ਉਹ ਵੀ ਸਬਜ਼ੀ ਆਪਾਂ ਨੂੰ ਹੋਰ ਵਧੀਆ ਮਿਲਜੇ ਹਾਂ ਕੋਈ ਮਾੜੀ ਆਵੇ ਵੀ ਤਾਂ ਤੁਸੀਂ ਸਾਈਡ ਰੱਖ ਲਿਆ ਕਰੋ ਸਾਨੂੰ ਔਰਗੈਨਿਕ ਵਾਲੀਆਂ ਦੇ ਦਿਆ ਕਰੋ ਆਪਣੇ ਵਧੀਆ ਠੀਕ ਹੈ ਅਤੇ ਉਹ ਸਮਾਨ ਭਿਜਵਾ ਦਿਓ ਜਿਹੜੀਆਂ ਸਬਜ਼ੀਆਂ ਤੁਹਾਨੂੰ ਮੈਂ ਕਹੀਆਂ ਹਾਂਜੀ ਠੀਕ ਨਹੀਂ ਜੀ ਹੁਕਮ ਬਸ ਹੋਰ ਜ ਜਦੋਂ ਲੈਣੀ ਹੋਏਗੀ ਕੋਈ ਹੋਰ ਉਦੋਂ ਤੁਹਾਨੂੰ ਕੌਲ ਕਰ ਦੇਵਾਂਗੇ ਠੀਕ ਠੀਕ